ਪੰਜ ਹਜ਼ਾਰ ਚਾਰ ਸੌ ਤੀਹ ਦੋ ਹਜ਼ਾਰ ਪੰਜ ਸੌ ਪੰਜਾਹ ਛੇ ਹਜ਼ਾਰ ਤਿੰਨ ਸੌ ਤੇਰ੍ਹਾਂ ਸੱਠ ਲੱਖ ਚਾਲ੍ਹੀ ਹਜ਼ਾਰ ਛੇ ਸੌ ਪੰਦਰਾਂ ਅੱਠ ਲੱਖ ਬਾਹਠ ਹਜ਼ਾਰ ਨੌ ਸੌ ਪੱਚੀ